ਮੈਨੂੰ ਸੂਈ ਨਾਲ ਟਾਂਕਾ ਲਾਣਾ ਸਭ ਤੋਂ ਬਹੁਤ ਔਖਾ ਲੱਗਦਾ ਹੈ ਕਿਉਂਕਿ ਬਹੁਤ ਬਰੀਕੀ ਦਾ ਕੰਮ ਵੀ ਹੈ ਤੇ ਮੈਨੂੰ ਬਹੁਤ ਹੀ ਔਖਾ ਲੱਗਦਾ ਹੈ ਮੇਰੇ ਟਾਂਕੇ ਲੱਗਣ ਵਾਲੇ ਕੱਪੜੇ ਬਹੁਤ ਦਿਨਾਂ ਤੱਕ ਪਏ ਰਹਿੰਦੇ ਹਨ ਅਤੇ ਸਭ ਤੋਂ ਪਹਿਰਾਵਾ ਔਖਾ ਸਭ ਤੋਂ ਔਖਾ ਪਹਿਰਾਵਾ ਮੈਨੂੰ ਸਾੜੀ ਲੱਗਦਾ ਹੈ ਕਿਉਂਕਿ ਜਦੋਂ ਪਹਿਲੀ ਵਾਰੀ ਜਦੋਂ ਮੈਂ ਸਾੜੀ ਪੈਨੀ ਸੀ ਤਾਂ ਮੇਰਾ ਪੱਲੂ ਡਿੱਗ ਰਿਹਾ ਸੀ ਜਿਸ ਕਰਕੇ ਮੈਨੂੰ ਸਾੜੀ ਵਿੱਚ ਬਹੁਤ ਔਖਾ ਲੱਗਦਾ ਹੈ ਅਤੇ ਸਾੜੀ ਵਿੱਚ ਚੱਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਚੱਲਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਇਸ ਲਈ ਮੈਨੂੰ ਜਿਆਦਾ ਸਾੜੀ ਪਹਿਨਣਾ ਪਸੰਦ ਨਹੀਂ ਹੈ ਮੈਨੂੰ ਜਿਆਦਾ ਸਲਵਾਰ ਸੂਟ ਪਹਿਨਣਾ ਹੀ ਪਸੰਦ ਹੈ ਅਤੇ ਮੈਂ ਜਿਆਦਾ ਸਲਵਾਰ ਸੂਟ ਹੀ ਪਹਿਨਦੀ ਹਾਂ ਸਾੜੀ ਤਾਂ ਮੈਂ ਉਦੋਂ ਪਹਿਨਦੀ ਆਂ ਜਦੋਂ ਮੈਨੂੰ ਕਿਤੇ ਜਿਆਦਾ ਜਿਆਦਾ ਜਰੂਰਤ ਲੱਗਦੀ ਹੈ ਪਰ ਮੈਂ ਜਿਆਦਾ ਖੁਸ਼ ਸਲਵਾਰ ਸੂਟ ਵਿੱਚ ਪਾ ਕੇ ਹੀ ਹੁੰਦੀ ਹਾਂ ਅਤੇ ਇਸੇ ਤਰ੍ਹਾਂ ਹੀ ਮੈਨੂੰ ਜਦੋਂ ਮੈਂ ਪਹਿਲੀ ਵਾਰੀ ਸਾੜੀ ਪਹਿਨੀ ਸੀ ਤਾਂ ਮੈਨੂੰ ਬਹੁਤ ਮੁਸ਼ਕਿਲ ਲੱਗ ਰਿਹਾ ਸੀ